ਉਣੱਤੀ ਨਵੰਬਰ ਉੱਨੀ ਸੌ ਉਣਾਸੀ ਪੰਜ ਨਵੰਬਰ ਉੱਨੀ ਸੌ ਉਣਾਸੀ ਬਾਰ੍ਹਾਂ ਨਵੰਬਰ ਦੋ ਹਜ਼ਾਰ ਤਿੰਨ ਬਾਰ੍ਹਾਂ ਅਕਤੂਬਰ ਦੋ ਹਜ਼ਾਰ ਦੋ ਪੱਚੀ ਅਗਸਤ ਦੋ ਹਜ਼ਾਰ ਗਿਆਰ੍ਹਾਂ